ਅੱਜ ਕੱਲ ਹੈਲਥ ਕੇਅਰ ਸਿਸਟਮ ਵਿੱਚ ਮੈਂ ਕਾਫੀ ਬੇਹਤਰੀ ਮਹਿਸੂਸ ਕਰ ਰਹੀ ਹਾਂ ਸਰਕਾਰ ਦੇ ਵੱਲੋਂ ਕਾਫੀ ਅੱਛੇ ਛੇ ਚੰਗੇ ਉਪਰਾਲੇ ਕੀਤੇ ਜਾ ਰਹੇ ਆ ਜਿਵੇਂ ਮੈਡੀਕਲ ਚੈੱਕਅਪ ਦਾ ਮੈਂ ਜਿਹੜੀ ਚੀਜ਼ ਮੈਨੂੰ ਪਸੰਦ ਆ ਰਹੀ ਹੈ ਕਿ ਸਕੂਲਾਂ ਦੇ ਵਿੱਚ ਵੀ ਬੱਚਿਆਂ ਦਾ ਚੈੱਕਅਪ ਸਰਕਾਰ ਵੱਲੋਂ ਟਾਈਮ ਲਈ ਕਰਵਾਇਆ ਜਾ ਰਿਹਾ ਜਿਹੜੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆ ਉਹਨਾਂ ਦੇ ਪੇਰੈਂਟਸ ਜਿਹੜੇ ਹੁੰਦੇ ਆ ਉਹ ਬੇਚਾਰੇ ਗਰੀਬ ਮਜ਼ਦੂਰ ਵਰਗ ਹੁੰਦੇ ਆ ਉਹ ਆਪਣੇ ਬੱਚੇ ਨੂੰ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਛੁੱਟੀ ਕਰ ਲਈ ਉਹਨਾਂ ਦੀ ਦਿਹਾੜੀ ਮਰਦੀ ਹੈ ਉਹ ਹੋਸਪੀਟਲਾਂ ਤੱਕ ਨਹੀਂ ਪਹੁੰਚ ਕਰਦੇ ਹੈਗੇ ਸੋ ਸਰਕਾਰ ਦਾ ਇਹ ਉਪਰਾਲਾ ਮੈਨੂੰ ਬਹੁਤ ਚੰਗਾ ਲੱਗਦਾ ਕਿ ਸਕੂਲਾਂ ਦੇ ਵਿੱਚ ਵੀ ਹੈਲਥ ਚੈੱਕਅਪ ਹੁੰਦਾ ਆ ਸੋ ਬੱਚਿਆਂ ਨੂੰ ਦਵਾਈਆਂ ਵੀ ਪਹੁੰਚਦੀਆਂ ਆ ਜਿਵੇਂ ਐਲਬਲੈਂਡਾਜ਼ੋਲ ਹੈ ਜਾਂ ਹੋਰ ਦਵਾਈਆਂ ਆਇਰਨ ਵਗੈਰਾ ਦੇ ਆਇਰਨ ਪੋਲੀਕ ਐਸਿਡ ਦੀਆਂ ਦਵਾਈਆਂ ਦਿੰਦੀ ਦਿੱਤੀਆਂ ਜਾ ਰਹੀਆਂ ਰੈਗੂਲਰਲੀ ਇਹਤੋਂ ਇਲਾਵਾ ਡਿਸਪੈਂਸਰੀਆਂ ਦੇ ਵਿੱਚ ਵੀ ਮੈਂ ਕਾਫੀ ਅੱਛਾ ਸਿਸਟਮ ਦੇਖਿਆ ਵੀ ਹੁਣ ਡਿਸਪੈਂਸੀਆਂ ਦੇ ਵਿੱਚ ਵੀ ਇਹਨਾਂ ਨੇ ਬਿਠਾਏ ਹੋਏ ਆ ਸਾਰੇ ਡੋਕਟਰਜ਼ ਵਗੈਰਾ ਪਿੰਡਾਂ ਦੇ ਵਿੱਚ ਡਿਸਪੈਂਸਰੀ ਪਿੰਡ ਪਿੰਡ ਵਿੱਚ ਡਿਸਪੈਂਸਰੀ ਖੁੱਲੀ ਹੋਈ ਹੈ ਸੋ ਇੱਕ ਅਪਰੋਚੇਬਲ ਹੋ ਗਿਆ ਸਾਰੇ ਲੋਕਾਂ ਲਈ ਕਿ ਜੇ ਉਹਨਾਂ ਨੂੰ ਡੋਕਟਰ ਦੀ ਸੇਵਾ ਦੀ ਲੋੜ ਹੈ ਤਾਂ ਬੰਦਾ ਫਟਾਫਟ ਡਿਸਪੈਂਸਰੀ ਜਾ ਸਕਦਾ ਆ ਹੋਸਪਿਟਲਾਂ ਦੇ ਵਿੱਚ ਵੀ ਕਾਫੀ ਸੁਧਾਰ ਦਿਖ ਰਿਹਾ ਪਹਿਲਾਂ ਨਾਲੋਂ ਨਵੀਂ ਡੋਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਚੰਗੀ ਤਰ੍ਹਾਂ ਚੈੱਕਅਪ ਕੀਤਾ ਜਾ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਚੰਗੀਆਂ ਲੱਗ ਰਹੀਆਂ ਕਿਉਂਕਿ ਸਿਹਤ ਜਿਹੜਾ ਸਾਡਾ ਆਮ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ ਸੋ ਇਹ ਮਤਲਬ ਇਹਦੇ ਵੱਲ ਸਰਕਾਰ ਨੂੰ ਧਿਆਨ ਦੇਣਾ ਬਣਦਾ ਹੀ ਹੈ ਤਾਂ ਕਿ ਜਿਹੜਾ ਮਤਲਬ ਸਾਡੀ ਜਿਹੜੀ ਜਨਰੇਸ਼ਨ ਹੈ ਇਹ ਆ ਜਿਹੜੀ ਸਾਡੀ ਜਨਸੰਖਿਆ ਉਹ ਸਵਸਥ ਹੋਵੇ ਜੋ ਸਵਸਥ ਹੋ ਗਈ ਤਾਂ ਹੀ ਦੇਸ਼ ਦੀ ਕੋਈ ਤਰੱਕੀ ਹੋਵੇਗੀ ਜੇ ਆਮ ਲੋਕ ਬਿਮਾਰ ਹੋਣਗੇ ਤਾਂ ਨਾ ਤਾਂ ਸਮਾਜ ਵਿੱਚ ਉਹ ਕੁਝ ਆਪਣਾ ਹਿੱਸਾ ਯੋਗਦਾਨ ਪਾ ਸਕਦੇ ਆ ਨਾ ਹੀ ਉਹ ਆਪਣੀ ਜ਼ਿੰਦਗੀ ਚੰਗੀ ਜੀ ਸਕਦੇ ਹਾਂ ਸੋ ਮੈਨੂੰ ਜਿਹੜੇ ਅੱਜਕੱਲ ਸਿਸਟਮ ਦੇ ਵਿੱਚ ਸੁਧਾਰ ਹੈ ਕੁਝ ਕਾਫੀ ਪਸੰਦ ਆ ਰਹੇ ਆ ਇਹਦੇ ਲਈ ਵਧੀਆ ਲੱਗ ਰਿਹਾ ਸਾਰਾ ਕੁਝ